ਲੋਕ ਵਿਆਹ 'ਤੇ ਲਾੜੀ ਨੂੰ ਬਹੁਤ ਤਰ੍ਹਾਂ ਦੀਆਂ ਪੇਂਟਿੰਗਾਂ ਅਤੇ ਹੋਰ ਤਰ੍ਹਾਂ ਦੇ ਗਿਫ਼ਟ ਆਈਟਮਸ ਦਿੰਦੇ ਹਨ ਜੋ ਕਿ ਅੱਜ ਕੱਲ੍ਹ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਪ੍ਰਚੱਲਿਤ ਹਨ ਅਤੇ ਲਾੜੀ ਨੂੰ ਦਾਜ ਵਿੱਚ ਬਹੁਤ ਤਰ੍ਹਾਂ ਦੇ ਸਮਾਨ ਦਿੱਤੇ ਜਾਂਦੇ ਹਨ ਜਿਹਨਾਂ ਵਿੱਚੋਂ ਫਰਨੀਚਰਸ ਵਿੱਚ ਬਹੁਤ ਜ਼ਿਆਦਾ ਤਰ੍ਹਾਂ ਦਾ ਸਮਾਨ ਹੁੰਦਾ ਹੈ ਜਿਸ ਤਰ੍ਹਾਂ ਬੈਡ ਸੈੱਟ ਸੋਫਾ ਸੈੱਟ ਅਲਮਾਰੀ ਪੇਟੀ ਅਤੇ ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਇਲੈਕਟ੍ਰੋਨਿਕਸ ਉਤਪਾਦ ਵੀ ਦਿੱਤੇ ਜਾਂਦੇ ਹਨ ਜਿਸ ਤਰ੍ਹਾਂ ਟੀ ਵੀ ਫਰਿੱਜ ਏਸੀ ਕੂਲਰ ਪੱਖੇ ਅਤੇ ਇਹ ਉਸਨੂੰ ਇੱਕ ਤੋਹਫੇ ਦੇ ਤੌਰ 'ਤੇ ਦਿੱਤਾ ਜਾਂਦਾ ਹੈ